ਸਤਿ ਸ਼੍ਰੀ ਅਕਾਲ ਜੀ ਹਾਂਜੀ ਬੋਲੋ ਹਾਂਜੀ ਭਾਵੇਂ ਤਰਨ ਤਾਰਨ ਸ਼ਹਿਰ ਛੋਟਾ ਹੈ ਪਰ ਸਾਡੇ ਨੌ ਇੱਥੇ ਬਹੁਤ ਸਾਰੀਆਂ ਨੌਕਰੀਆਂ ਹਨ ਅਤੇ ਜਿਸ ਤਰ੍ਹਾਂ ਕਿ ਬਹੁਤ ਹੀ ਵੱਡੇ ਵੱਡੇ ਸਕੂਲ ਹਨ ਜਿਸ 'ਚ ਤੁਸੀਂ ਟੀਚਰ ਦੀ ਨੌਕਰੀ ਕਰ ਸਕਦੇ ਹੋ ਆਈਲੈਟ ਸੈਂਟਰ ਹਨ ਜਿੱਥੇ ਤੁਸੀਂ ਕੋਚਿੰਗ ਦੇ ਸਕਦੇ ਹੋ ਅਤੇ ਹੋਰ ਵੀ ਬਹੁਤ ਸਾਰੀਆਂ ਫੈਸਿਲਿਟੀਜ਼ ਨੇ ਹਾਂਜੀ ਇੱਥੇ ਬਹੁਤ ਹੀ ਵੱਡੇ ਵੱਡੇ ਆਈਲੈਸ ਸੈਂਟਰ ਹਨ ਮੈਂ ਵੀ ਇੱਕ ਆਈਲੈਸ ਸੈਂਟਰ 'ਚ ਹੀ ਪੜ੍ਹਾਉਂਦੀ ਹਾਂ ਇੱਦਾਂ ਕਰੋ ਤੁਸੀਂ ਕੱਲ੍ਹ ਆਪਣੇ ਸਾਰੇ ਡਾਕੂਮੈਂਟ ਲੈ ਕੇ ਮੇਰੇ ਕੋਲ ਆ ਜਾਓ ਉਹਦੀਆਂ ਫੋਟੋ ਕੋਪੀਆਂ ਅਤੇ ਓਰਿਜਨਲ ਡੋਕੂਮੈਂਟ ਅਤੇ ਮੈਂ ਤੁਹਾਨੂੰ ਕੱਲ੍ਹ ਇੱਥੇ ਹੀ ਗਿਆਰਾਂ ਵਜੇ ਮਿਲੂੰਗੀ ਹਾਂਜੀ ਸਤਿ ਸ਼੍ਰੀ ਅਕਾਲ